ਮੈਂ ਨਵਾਂਸ਼ਹਿਰ ਪਿੰਡ 'ਚ ਤੋਂ ਹੈ ਜੀ ਅਤੇ ਮੈਂ ਮਤਲਬ ਨਵਾਂਸ਼ਹਿਰ ਪਿੰਡ ਨੂੰ ਦੂਜੇ ਨਾਮ ਸ਼ਹੀਦ ਸ਼੍ਰੀ ਸ ਸ਼ਹੀਦ ਭਗਤ ਸਿੰਘ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਸ਼ਹੀਦ ਭਗਤ ਸਿੰਘ ਦਾ ਪਿੰਡ ਹੈ ਖਟਕੜ ਕਲਾਂ ਮੈਨੂੰ ਬਹੁਤ ਪਸੰਦ ਹੈ ਉਹ ਪਿੰਡ ਮਤਲਬ ਉੱਥੇ ਸਾਨੂੰ ਮਤਲਬ ਜਾ ਕੇ ਬਹੁਤ ਮਨਪਸੰਦ ਲੱਗਦਾ ਹੈ ਅਤੇ ਪ੍ਰੋਸ਼ਾਹਿਤ ਕਰਨ ਵਾਲੀ ਚੀਜ਼ਾਂ ਵੀ ਹੈ ਸ਼ਹੀਦ ਭਗਤ ਸਿੰਘ ਦੀ ਜੀ ਦੀਆਂ ਅਤੇ ਮਤਲਬ ਜੇ ਮੇੇਰੇ ਰਿਸ਼ਤੇਦਾਰ ਆਉਂਦੇ ਹੈ ਤਾਂ ਫਿਰ ਮੈਂ ਉਹਨਾਂ ਨੂੰ ਉੱਥੇ ਘੁੰਮਾਉਣ ਲੈ ਜਾਂਦੀ ਹਾਂ ਉੱਥੇ ਉਹਨਾਂ ਦੇ ਜੁੱਤੇ ਵਗੈਰਾ ਅਤੇ ਕੱਪੜੇ ਵਗੈਰਾ ਅਤੇ ਖਿਡੋਣੇ ਵਗੈਰਾ ਲੱਗੇ ਹੋਏ ਹੈ ਅਤੇ ਉੱਥੇ ਲੋਕਾਂ ਨੇ ਰੁਜ਼ਗਾਰ ਕੀਤਾ ਵਿਆ ਅਤੇ ਉੱਥੇ ਰਹਿੰਦੇ ਵੀ ਹੈ ਲੋਕ ਅਤੇ ਉਹ ਪਿੰਡ ਬਹੁਤ ਹੀ ਵਧੀਆ ਹੈ ਅਤੇ ਮੈਨੂੰ ਉੱਥੇ ਜਾ ਕੇ ਲੱਗਦਾ ਹੈ ਕਿ ਮਤਲਬ ਆਪਣੇ ਪਿੰਡ ਵਰਗਾ ਲੱਗਦਾ ਉੱਥੇ ਤੋਂ ਆਉਣ ਦਾ ਜੀਅ ਨਹੀਂ ਕਰਦਾ ਮਤਲਬ ਬਹੁਤ ਹੀ ਵਧੀਆ ਪਿੰਡ ਹੈ ਮੈਂ ਤਾਂ ਚਾਹੁੰਦੀ ਹਾਂ ਕਿ ਮੈਂ ਮੈਂ ਤਾਂ ਚਾਹੁੰਦੀ ਹਾਂ ਕਿ ਮਤਲਬ ਮੇਰੇ ਸਾਰੇ ਰਿਸ਼ਤੇਦਾਰ ਆਉਣ ਅਤੇ ਇੱਕ ਵਾਰ ਉੱਥੇ ਜਾ ਆਉਣ ਅਤੇ ਮਤਲਬ ਦੇਖਣ ਕਿ ਮਤਲਬ ਕਿੱਦਾਂ ਦਾ ਹੈ ਪਿੰਡ ਮਤਲਬ ਉਹਦੇ ਬਾਰੇ ਪਤਾ ਕਰਨ ਮਤਲਬ ਉਹਦੇ ਬਾਰੇ ਸਾਨੂੰ ਨੌਲੇਜ ਵਗੈਰਾ ਮਿਲਦੀ ਹੈ ਅਤੇ ਫਿਰ ਸਾਨੂੰ ਮਤਲਬ ਬਹੁਤ ਵਧੀਆ ਪਿੰਡ ਹੈ ਉਹ